ਹੈਲੋ ਹਾਂਜੀ ਹਾਂਜੀ ਹਾਂਜੀ ਕਿਸ ਚੀਜ਼ ਦੀ

ਦੱਸੋ ਕੀ ਕੰਪਲੇਂਟ ਸੀ ਨਹੀਂ ਜੀ ਇੱਦਾਂ ਤਾਂ ਅਸੀਂ ਕਦੇ ਕੀਤਾ ਹੀ ਨਹੀਂ ਓਵਰਟੇਕ ਤਾਂ ਨਹੀਂ ਨਹੀਂ ਮੈਂ ਤਾਂ ਅ ਕੁਛ ਕੀਤ ਐਸ ਕੀਤਾ ਇਸ ਤਰ੍ਹਾਂ ਕੀਤਾ ਵੀ ਨਹੀਂ ਮੈਂ ਤਾਂ ਕਿਸੇ ਬਾਈਕ ਨੂੰ ਓਵਰਟੇਕ ਵੀ ਨਹੀਂ ਕੀਤਾ ਅੱਗੋਂ ਨਹੀਂ ਜੀ ਇੰਨੀ ਮਿਸਟੇਕ ਤਾਂ ਨਹੀਂ ਮੈਂ ਕਰ ਸਕਦਾ ਉਹ ਤਾਂ ਰੋ ਰੋਡ ਦੀ ਰੋਡ ਦੀ ਦਿੱਕਤ ਹੋ ਸਕਦੀ ਆ

ਹਾਂਜੀ ਦੱਸੋ

ਨਹੀਂ ਜਿਸ ਤਰ੍ਹਾਂ ਦੀ ਅੱਗੇ ਤੋਂ ਧਿਆਨ ਰੱਖਾਂਗੇ ਚਲੋ ਸੌਰੀ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖੂਗੇ ਅੱਛਾ ਹੈਲੋ ਸੋਰੀ ਮੈਮ ਹਾਂਜੀ ਸੋਰੀ ਅੱਗੇ ਤੋਂ ਇਸ ਚੀਜ਼ ਦਾ ਪੂਰਾ ਧਿਆਨ ਰੱਖਾਂਗੇ ਮੈਮ ਸੋਰੀ ਚਲੋ ਇੱਕ ਚਾਂਸ ਦੇ ਦਓ ਅੱਗੇ ਤੋਂ ਨਹੀਂ ਹੁੰਦਾ ਓਕੇ ਓਕੇ ਮੈਮ